ਪੰਛੀ ਅਲੱਗ ਅਲੱਗ ਪੰਛੀ ਅਲੱਗ ਅਲੱਗ ਵਿਵਹਾਰ ਦਾ ਵਰਤਾਵਾ ਕਰਦੇ ਹਨ ਬਹੁਤ ਸਾਰੇ ਪੰਛੀ ਜਿਹੜੇ ਕਿ ਆਲ੍ਹਣਿਆਂ ਵਿੱਚ ਰਹਿੰਦੇ ਹਨ ਉਹ ਆਪਣੇ ਬੱਚਿਆਂ ਨਾਲ ਅਲੱਗ ਅਲੱਗ ਦਾ ਵਿਵਹਾਰ ਕਰਦੇ ਹਨ ਜਿਵੇਂ ਕਿ ਚਿੜੀਆਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਆਲ੍ਹਣਿਆਂ ਵਿੱਚ ਰੱਖ ਕੇ ਚੋਗਾ ਚੁਗਾਂਦੀਆਂ ਹਨ ਅਤੇ ਉਹਨਾਂ ਨੂੰ ਪਾਲਦੀਆਂ ਹਨ ਫਿਰ ਵੱਡੇ ਹੋ ਕੇ ਉਹ ਪੰਛੀ ਉੱਡ ਜਾਂਦੇ ਹਨ ਲੇਕਿਨ ਬਹੁਤ ਸਾਰੇ ਪੰਛੀ ਇਹੋ ਜਿਹੇ ਵੀ ਹੈ ਨੇ ਜੋ ਕਿ ਆਪਣੇ ਬੱਚਿਆਂ ਦੇ ਆਪਣੇ ਆਂਡਿਆਂ ਨੂੰ ਦੂਸਰਿਆਂ ਦੇ ਘੋਂਸਲੇ ਵਿੱਚ ਰੱਖ ਆਉਂਦੇ ਹਨ ਅਤੇ ਉਹਨਾਂ ਦਾ ਪਾਲਣ ਪੋਸ਼ਣ ਦੂਸਰੇ ਪੰਛੀ ਕਰਦੇ ਹਨ ਅਤੇ ਉਹਨਾਂ ਦੇ ਪੰਛੀ ਦੂਸਰਿਆਂ ਪੰਛੀਆਂ ਤੋਂ ਹੀ ਆਪਣਾ ਪਾਲਣ ਪੋਸ਼ਣ ਕਰਾਉਂਦੇ ਹਨ ਅਤੇ ਬਾਅਦ ਵਿੱਚ ਉਹ ਉਹਨਾਂ ਤੋਂ ਹੀ ਉੱਡਣਾ ਸਿੱਖਦੇ ਹਨ ਅਤੇ ਉਹ ਉਡਾਰੀ ਮਾਰ ਜਾਂਦੇ ਹਨ ਪੰਛੀਆਂ ਪੰਛੀ ਸੁਭਾਅ ਤੋਂ ਬਹੁਤ ਹੀ ਕੋਮਲ ਹੁੰਦੇ ਹਨ ਇਹ ਕਦੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਇਹ ਹਮੇਸ਼ਾ ਆਪਣਾ ਕੰਮ ਕਰਦੇ ਹਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਕਿਸੇ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਹਮੇਸ਼ਾ ਇਨਸਾਨ ਦੇ ਸਹਾਇਕ ਹੁੰਦੇ ਹਨ ਇਹ ਕੀੜੇ ਮਕੌੜੇ ਖਾ ਕੇ ਸਾਡਾ ਬਹੁਤ ਸਾਰਾ ਅਨਾਜ ਨੁਕਸਾਨ ਹੋਣ ਤੋਂ ਬਚਾ ਲੈਂਦੇ ਹਨ ਅਤੇ ਬਹੁਤ ਸਾਰੇ ਪੰਛੀ ਪੰਛੀਆਂ ਨੂੰ ਅਸੀਂ ਇਨਸਾਨ ਦਾ ਦੋਸਤ ਕਹਿੰਦੇ ਹਾਂ ਧੰਨਵਾਦ